ਸਤਿ ਸ਼੍ਰੀ ਅਕਾਲ ਮੇਰਾ ਨਾਮ ਵਾਸੂਦਾ ਹੈ ਅਤੇ ਮੈਂ ਜ਼ਿਲ੍ਹਾ ਪਠਾਨਕੋਟ ਦੀ ਰਹਿਣ ਵਾਲੀ ਹਾਂ ਅਤੇ ਅੱਜ ਮੈਂ ਤੁਹਾਨੂੰ ਉਸ ਚੀਜ਼ ਬਾਰੇ ਤੁਹਾਡੇ ਨਾਲ ਗੱਲ ਕਰਨੀ ਜੀ ਜੋ ਕਿ ਮੇਰੀ ਸਭ ਤੋਂ ਸੁੰਦਰ ਯਾਤਰਾ ਸੀ ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਮੇਰੀ ਸਭ ਤੋਂ ਸੁੰਦਰ ਯਾਤਰਾ ਸੀ ਕਿ ਮੈਂ ਧਰਮਸ਼ਾਲਾ ਗਈ ਸੀ ਟ੍ਰੈਗਿੰਗ ਕਰਨ ਅਤੇ ਟ੍ਰੈਗਿੰਗ ਕਰਨ ਟਾਇਮ ਮਤਲਬ ਆਪਾਂ ਤੁਰੰਤ ਚਲੇ ਗਏ ਗਾਇਡਰ ਨਾਲ ਆਪਾਂ ਗਏ ਸੀ ਅਤੇ ਜਾਂਦੇ ਟਾਇਮ ਸਾਨੂੰ ਬਹੁਤ ਹੀ ਜ਼ਿਆਦਾ ਤਕਲੀਫ਼ ਮਤਲਬ ਹੋਈ ਕਿਉਂਕਿ ਕਾਫ਼ੀ ਦੋ ਹਜ਼ਾਰ ਫਿਟ ਉੱਪਰ ਸੀ ਉੱਚਾ ਸੀ ਫਿਰ ਆਪਾਂ ਬਲਵ ਹੌਲੀ ਹੌਲੀ ਥੋੜ੍ਹੀ ਜਗ੍ਹਾ ਰੈਸਟ ਕੀਤੀ ਥੋੜ੍ਹੀ ਜਗ੍ਹਾ ਰੁਕੇ ਫਿਰ ਮਤਲਬ ਹੌਲੀ ਹੌਲੀ ਉਸ ਜਗ੍ਹਾ ਤੱਕ ਮਤਲਬ ਪਹੁੰਚਿਆ ਕਰਦੇ ਸੀ ਪਰ ਆਪਾਂ ਮਤਲਬ ਕਾਫ਼ੀ ਹੀ ਟਾਇਮ ਲੱਗਿਆ ਸਾਨੂੰ ਉੱਥੇ ਤੱਕ ਪਹੁੰਚਣ 'ਚ ਸਾਨੂੰ ਮਤਲਬ ਆਪਾਂ ਸਾਰੇ ਸਾਥੀ ਸੀ ਅਤੇ ਅਗਰ ਜਿੱਦਾਂ ਕਿ ਦਿਨ ਢਲ ਜਾਂਦਾ ਹੈ ਤਾਂ ਆਪਾਂ ਮਤਲਬ ਉਸ ਟਾਇਮ ਸੂਰਜ ਢਲਦਾ ਵੀ ਦੇਖਿਆ ਸੀ ਜਦੋਂ ਸੂਰਜ ਸੂਰਜ ਡੁੱਬਿਆ ਕਰਦਾ ਸੀ ਉਸ ਟਾਇਮ ਆਪਾਂ ਉਹ ਨਜ਼ਾਰਾ ਦੇਖਿਆ ਸੀ ਆਪਾਂ ਉੱਥੇ ਮਤਲਬ ਉਸ ਟਾਇਮ ਬੈਠਦੇ ਸੀ ਰੈਸਟ ਕਰਿਆ ਕਰਦੇ ਸੀ ਤਾਂ ਆਪਾਂ ਉਸ ਟਾਇਮ ਸੂਰਜ ਨੂੰ ਡੁੱਬਦੇ ਵੀ ਦੇਖਿਆ ਸੀ ਪਰ ਉਹ ਆਪਾਂ ਨਜ਼ਾਰਾ ਉਹ ਆਪਣੇ ਘਰੋਂ ਨਹੀਂ ਦੇਖ ਸਕਦੇ ਉਹ ਮਤਲਬ ਵੱਖਰਾ ਹੀ ਨਜ਼ਾਰਾ ਹੁੰਦਾ ਹੈ ਜੋ ਆਪਾਂ ਆਪਣੇ ਘਰ ਤੋਂ ਨਹੀਂ ਦੇਖ ਸਕਦੇ ਇਵੇਂ ਲੱਗਦਾ ਕਿ ਜਿੱਦਾਂ ਸੂਰਜ ਸਾਡੇ ਨੇੜੇ ਹੀ ਹੈ ਅਤੇ ਸਾਡੇ ਨੇੜੇ ਉਹ ਡੁੱਬਿਆ ਕਰਦਾ ਹੈ ਅਤੇ ਹੁਣ ਗੱਲ ਕਰੀਏ ਫਿਰ ਆਪਾਂ ਫਿਰ ਟਰੈਗਿੰਗ ਆਪਣੀ ਸਟਾਟ ਕੀਤੀ ਤਾਂ ਆਪਾਂ ਦੋ ਹਜ਼ਾਰ ਫਿਟ ਉੱਪਰ ਜਿਹੜੀ ਇੱਕ ਐਹੈਂ ਸੀ ਉੱਥੇ ਆਪਾਂ ਪੁੱਜੇ ਠੀਕ ਹੈ ਉੱਥੇ ਆਪਾਂ ਪੁੱਜ ਕੇ ਪਰ ਉੱਥੇ ਮਤਲਬ ਆਪਾਂ ਬਹੁਤ ਸਾਰਾ ਆਪਾਂ ਬਹੁਤ ਥੱਕ ਗਏ ਅਤੇ ਆਪਾਂ ਰੈਸਟ ਕੀਤੀ ਪਰ ਜਦੋਂ ਮਤਲਬ ਜਿੱਦਾਂ ਹੀ ਸਵੇਰ ਹੋਈ ਅਤੇ ਆਪਾਂ ਦੇਖਿਆ ਕਿ ਸੂਰਜ ਚੜ੍ਹਿਆ ਕਰਦਾ ਹੈ ਅਤੇ ਉਹ ਨਜ਼ਾਰਾ ਇੰਨਾ ਦੇਖਣ ਵਾਲਾ ਸੀ ਕਿ ਉੱਥੇ ਜਿੱਦਾਂ ਹੀ ਸੂਰਜ ਚੜ੍ਹਿਆ ਇੰਨਾ ਮਤਲਬ ਇੰਨਾ ਸੋਹਣਾ ਨਜ਼ਾਰਾ ਸੀ ਉਹ ਕਿ ਸੂਰਜ ਇੱਦਾਂ ਲੱਗਿਆ ਜਿਵੇਂ ਸਾਡੇ ਕੋਲ ਹੀ ਹੈ ਅਤੇ ਸਾਡੇ ਕੋਲ ਲਾਗੋਂ ਆਪਾਂ ਹੀ ਉਹਨੂੰ ਮਤਲਬ ਉੱਪਰ ਕਰਿਆ ਕਰਦੇ ਹਾਂ ਅਤੇ ਮੈਂ ਹੋਰ ਇਹੀ ਦੱਸਣਾ ਚਾਹਾਂਗੀ ਕਿ ਮੇਰਾ ਬਹੁਤ ਹੀ ਵਧੀਆ ਐਕਸਪੀਰਐਂਸ ਸੀ ਹੋਰ ਧੰਨਵਾਦ